ਇੱਥੇ ਸਾਡੇ ਪਿੰਡਾਂ ਦੇ ਵਿੱਚ ਕਿ ਦੂਰੋਂ ਦੂਰੋਂ ਦੋ ਦੋ ਕਿਲੋਮੀਟਰ ਤੱਕ ਵੀ ਤੁਰ ਕੇ ਜਾਣਾ ਪੈਂਦਾ ਹੈ ਬੱਸ ਅ ਪਿੰਡਾਂ ਦੇ ਵਿੱਚ ਬਹੁਤ ਘੱਟ ਸਥਿਤੀ 'ਚ ਲਗਾਈਆਂ ਹੋਈਆਂ ਹਨ ਕਾਫੀ ਨਾਲੇ ਵਗੈਰਾ ਇਧਰ ਪਹਾੜੀ ਇਲਾਕੇ ਜਿਹੇ ਦੇ ਹੋਣ ਕਰਕੇ ਕਾਫੀ ਅ ਪੰਜਾਬ ਦੇ ਵਿੱਚ ਪਿੰਡ ਜਿਹੜੇ ਅ ਨੂੰ ਪਹਾੜ ਕਾਫੀ ਦੂਰ ਤੱਕ ਲੱਗਦਾ ਹੈ ਲੋਕਾਂ ਨੂੰ ਥੋੜ੍ਹੀ ਜਿਹੀ ਦਿੱਕਤ ਬੜੀ ਆਉਂਦੀ ਹੈ ਦੂਰ ਤੱਕ ਛੋਟੀਆਂ ਮੋਟੀਆਂ ਬੱਸਾਂ ਦੇ ਵਿੱਚ ਵੀ ਜਾ ਕੇ ਬੜੇ ਸ਼ਹਿਰਾਂ ਨੂੰ ਸਾਨੂੰ ਪਹੁੰਚਣਾ ਪੈਂਦਾ ਹੈ ਕਾਫੀ ਸਥਿਤੀ ਆਉਂਦੀ ਹੈਗੀ ਸੜਕਾਂ ਦੇ ਵਿੱਚ ਪੁਲ ਅਤੇ ਨਾਲਿਆਂ ਦੇ ਵਿੱਚ ਕੋਈ ਪੁਲੀਆਂ ਅਤੇ ਉਹ ਨਹੀਂ ਸਹੂਲਤ ਹੈਗੀ ਅਤੇ ਕਾਫੀ ਦਿੱਕਤ ਆਉਂਦੀ ਹੈਗੀ ਅਤੇ ਅ ਪੈਦਲ ਵੀ ਚੱਲਣਾ ਪੈਂਦਾ ਹੈ ਦੋ ਚਾਰ ਕਿਲੋਮੀਟਰ ਪੈਦਲ ਚੱਲ ਕੇ ਵੀ ਸਾਨੂੰ ਬੱਸ ਪਕੜਨੀ ਪੈਂਦੀ ਹੈ ਕਾਫੀ ਸਾਡੇ ਇਸ ਇਲਾਕੇ ਦਾ ਇਧਰ ਹਾਲਤ ਖਰਾਬ ਹਨ ਬ ਬਜ਼ੁਰਗ ਵਗੈਰਾ ਨੂੰ ਕਿੰਨੀਆਂ ਦਿੱਕਤਾਂ ਆ ਜਾਂਦੀਆਂ ਨੇ ਕਿਵੇਂ ਲੈ ਕੇ ਜਾਣਾ ਹੁੰਦਾ ਹੈ ਕੋਈ ਸਹੂਲਤ ਹੈ ਹੀ ਨਹੀਂ ਸਾਡੇ ਇੱਥੇ ਜਾਣਾ ਬੜਾ ਔਖਾ ਹੋ ਜਾਂਦਾ ਹੈ ਬੱਸ ਕਦੀ ਦੋ ਘੰਟੇ ਬਾਅਦ ਹੀ ਕਦੀ ਬੱਸ ਆਉਂਦੀ ਹੈ ਉਹ ਵੀ ਛੋਟੀ ਬੱਸ ਮਿੰਨੀ ਅਤੇ ਐਨੀ ਉਹ ਕਠਿਨਾਈਆਂ ਝੱਲਣੀਆਂ ਪੈਂਦੀਆਂ ਹਨ ਜੀ ਬੜਾ ਮੁਸ਼ਕਿਲ ਦਾ ਨਾਲ ਕ ਕਰਨਾ ਪੈਂਦਾ ਹੈ